ਮੈਂ ਔਨਲਾਈਨ ਕੂਲਰ ਦੀ ਐਡ ਦੇਖੀ ਸੀ ਅਤੇ ਮੈਨੂੰ ਇੱਕ ਕੂਲਰ ਦੀ ਲੋੜ ਸੀ ਇਸ ਕਰਕੇ ਮੈਂ ਇੱਕ ਕੂਲਰ ਦੀ ਐਡ ਦੇਖੀ ਅਤੇ ਉਹ ਮੈਨੂੰ ਵਧੀਆ ਲੱਗਿਆ ਅਤੇ ਮੈਂ ਉਹ ਔਨਲਾਈਨ ਮੰਗਵਾਇਆ ਉਹਦੀ ਪੇਮੈਂਟ ਕੀਤੀ ਔਨਲਾਈਨ ਅਤੇ ਔਨਲਾਈਨ ਪੇਮੈਂਟ ਕਰਕੇ ਉਹ ਮੰਗਵਾਇਆ ਅਤੇ ਉਹ ਮੈਨੂੰ ਜਦੋਂ ਉਹ ਆਇਆ ਪਰਚੇਜ ਕੀਤਾ ਮੈਂ ਤਾਂ ਉਹ ਵਧੀਆ ਸੀਗਾ ਅਤੇ ਉਹਦੇ ਫੰਕਸ਼ਨ ਵੀ ਵਧੀਆ ਨੇਗੇ ਅਤੇ ਉਹ ਊਂ ਵੀ ਪਲਾਸਟਿਕ ਦਾ ਗਾ ਅਤੇ ਪਲਾਸਟਿਕ ਦਾ ਗਾ ਤਾਂ ਕਿ ਵੀ ਜਿਹੜਾ ਲੋਹੇ ਦਾ ਹੁੰਦਾ ਗਾ ਉਹਦੇ ਨਾਲ ਬੱਚਿਆਂ ਨੂੰ ਸਾਂਟ ਲੱਗਣ ਦੀ ਵੀ ਡਰ ਰਹਿੰਦੀ ਹੈ ਜਿਹੜਾ ਪਲਾਸਟਿਕ ਦਾ ਉਹਦੇ ਨਾਲ ਬੱਚੇ ਨੂੰ ਸ਼ਾਂਟ ਵੀ ਨਹੀਂ ਹੁੰਦਾ ਗਾ ਬੱਚੇ ਕੋਲ ਫਿਰਦੇ ਰਹਿੰਦੇ ਆ ਕੋਈ ਡਰ ਨਹੀਂ ਗਾ ਅਤੇ ਉਹ ਉਹਦਾ ਪ੍ਰਾਈਜ ਵੀ ਠੀਕ ਲੱਗਿਆ ਮੈਨੂੰ ਜਿਹੜਾ ਮਾਰਕੀਟ 'ਚ ਉਹਦਾ ਪ੍ਰਾਈਜ ਮੈਂ ਪਤਾ ਕੀਤਾ ਜ਼ਿਆਦਾ ਗਾ ਅਤੇ ਔਨਲਾਈਨ ਉਸਦਾ ਪ੍ਰਾਈਜ ਘੱਟ ਸੀਗਾ ਅਤੇ ਉਹ ਵਧੀਆ ਕੁਆਲਿਟੀ ਦਾ ਗਾ ਜਿਸ ਤਰ੍ਹਾਂ ਮੈਂ ਦੇਖਿਆ ਸੀਗਾ ਔਨਲਾਈਨ ਅਤੇ ਉਹ ਉਸ ਤੋਂ ਵੀ ਵਧੀਆ ਹੀ ਲੱਗਿਆ ਮੈਨੂੰ ਵਧੀਆ ਚੀਜ਼ ਹੈਗੀ ਅਤੇ ਜਿੰਨੇ ਫੰਕਸ਼ਨ ਉਹਦੇ ਦੱਸੇ ਗਏ ਸੀਗੇ ਉਹ ਸਾਰੇ ਫੰਕਸ਼ਨ ਵੀ ਵਧੀਆ ਕੰਮ ਕਰਦੇ ਹੈਗੇ ਅਤੇ ਵਧੀਆ ਚੀਜ਼ ਹੈਗੀ ਅਤੇ ਮੈਂ ਉਹਦੇ ਬਾਰੇ ਅੱਗੇ ਵੀ ਪਰਚੇਜ ਕਰਨ ਬਾਰੇ ਕਹਿ ਰਹੀ ਆ ਵੀ ਆਪਣੇ ਆਲੇ ਦੁਆਲੇ ਜਿਹਨੂੰ ਵੀ ਚਾਹੀਦਾ ਗਾ ਵੀ ਭਈ ਉਹ ਚੀਜ਼ ਵਧੀਆ ਹੈਗੀ ਉਹਨੂੰ ਪਰਚੇਜ ਕਰੋ ਅਤੇ ਕੂਲਰ ਜੋ ਕਿ ਮਾਰ ਨਾਲੇ ਉਰਾਂ ਪਰਾਂ ਕਰਨ ਦੇ ਵਿੱਚ ਵੀ ਉਹਦੇ ਟਾਇਰ ਵੀ ਵਧੀਆ ਨੇਗੇ ਜਦੋਂ ਆਪਾਂ ਅੱਗੇ ਪਿੱਛੇ ਕਰਦੇ ਹਾਂ ਜਾਂ ਹੋਰ ਕਮਰੇ ਚੱਲੇ ਜਾਂਦੇ ਆ ਤਾਂ ਉਹ ਹੋਰ ਕਮਰੇ ਚੱਲੇ ਜਾਣ ਨਾਲ ਵੀ ਉਹਦੇ 'ਚ ਆਸਾਨੀ ਹੈਗੀ ਹਲਕਾ ਗਾ ਚੁੱਕਣ 'ਚ ਵੀ ਅਤੇ ਰੇੜਨ ਰੁੜਨ 'ਚ ਵੀ ਉਹ ਕੂਲਰ ਹੈ ਜਿਹੜਾ ਉਹਦੇ ਟਾਇਰ ਬਿਲਕੁਲ ਹਲਕੇ ਹੈਗੇ ਅਤੇ ਰੇੜ ਅਸਾਨੀ ਨਾਲ ਲੈ ਜਾਂਦੇ ਹਾਂ ਉਹ ਪਲਾਸਟਿਕ ਦਾ ਹੈਗਾ ਜਿਹੜਾ ਲੋਹੇ ਦਾ ਕੂਲਰ ਹੁੰਦਾ ਉਹ ਥੋੜ੍ਹਾ ਭਾਰਾ ਹੁੰਦਾ ਅਤੇ ਉਹਨੂੰ ਇਧਰ ਉੱਧਰ ਕਰਨ 'ਚ ਵੀ ਮੁਸ਼ਕਿਲ ਆਉਂਦੀ ਹੈ ਅਤੇ ਉਹ ਬਹੁਤ ਵਧੀਆ ਚੀਜ਼ ਹੈਗੀ